ਸਾਡੇ ਖੇਤਰ ਵਿੱਚ ਪ੍ਰਾਈਵੇਟ ਹਸਪਤਾਲ ਚਾਰ ਹਨ ਜਿਨ੍ਹਾਂ ਵਿੱਚ ਮਰੀਜ਼ ਦਾ ਇਲਾਜ ਕਰਵਾਉਣ ਲਈ ਇੱਕ ਤਾਂ ਵੱਧ ਕੀਮਤ ਚੁਕਾਉਣੀ ਪੈਂਦੀ ਹੈ ਦੂਜਾ ਕਾਰਨ ਇਹ ਹੈ ਕਿ ਇਹ ਹਸਪਤਾਲ ਸਾਡੇ ਖੇਤਰ ਤੋਂ ਕਾਫੀ ਦੂਰੀ 'ਤੇ ਪੈ ਜਾਂਦੇ ਹਨ ਐਂਬੂਲੈਂਸ ਮੌਕੇ 'ਤੇ ਮੁਹੱਈਆ ਕਰਵਾਉਣ ਦੀ ਸੇਵਾ ਨਹੀਂ ਹੈ ਕਿ ਖੇਤਰ ਵੱਡਾ ਹੋਣ ਕਰਕੇ ਚਾਰ ਹਸਪਤਾਲਾਂ ਵਿੱਚ ਛੇ ਐਂਬੂਲੈਂਸਾਂ ਹੀ ਹਨ ਜੋ ਕਿ ਕਈ ਵਾਰ ਲੋੜਵੰਦ ਨੂੰ ਮੌਕੇ 'ਤੇ ਉਸਦੀ ਸੇਵਾ ਨਹੀਂ ਮਿਲ ਸਕਦੀ ਇਸ ਕਰਕੇ ਹਸਪਤਾਲ ਵਿੱਚ ਮਰੀਜ਼ ਨੂੰ ਲਿਜਾਣ ਵਿੱਚ ਬਹੁਤ ਮੁਸ਼ਕਲਾਂ ਆਉਂਦੀਆਂ ਹਨ ਕਿਉਂਕਿ ਹਰ ਕਿਸੇ ਦੇ ਘਰ ਵਿੱਚ ਸਾਧਨ ਨਹੀਂ ਹੁੰਦਾ ਜਦੋਂ ਨੂੰ ਮਰੀਜ਼ ਨੂੰ ਲਿਜਾਣ ਲਈ ਸਾਧਨ ਦਾ ਬੰਦੋਬਸਤ ਕਰਦੇ ਹਾਂ ਉਦੋਂ ਤੱਕ ਮਰੀਜ਼ ਦੀ ਹਾਲਤ ਗੰਭੀਰ ਹੁੰਦੀ ਜਾਂਦੀ ਹੈ ਇਸ ਵਜ੍ਹਾ ਕਰਕੇ ਕਈ ਵਾਰ ਮਰੀਜ਼ ਦੀ ਹਾਲਤ ਗੰਭੀਰ ਹੁੰਦੀ ਹੈ ਜਾਂਦੀ ਹੈ ਅਤੇ ਸਾਧਨ ਜਾਂ ਐਬੂਲੈਂਸ ਦਾ ਇੰਤਜ਼ਾਮ ਨਹੀਂ ਕੀਤਾ ਜਾਂਦਾ ਜਾਂ ਨਹੀਂ ਹੋ ਸਕਦਾ ਇਸ ਕਰਕੇ ਕਈ ਲੋਕਾਂ ਦੀ ਜਾਨ ਵੀ ਗਈ ਹੈ ਜੋ ਕਿ ਸੁਣ ਕੇ ਬਹੁਤ ਨਿਰਾਸ਼ਾ ਹੁੰਦੀ ਹੈ